ਇੱਕੀ ਜੂਨ ਦੋ ਹਜ਼ਾਰ ਇੱਕ ਚਾਰ ਮਈ ਦੋ ਹਜ਼ਾਰ ਅਠਾਰ੍ਹਾਂ ਛੱਬੀ ਅਗਸਤ ਉੱਨੀ ਸੌ ਅਠਾਨਵੇਂ ਬਾਰ੍ਹਾਂ ਜਨਵਰੀ ਉੱਨੀ ਸੌ ਛਿਆਨਵੇਂ ਤਿੰਨ ਅਪ੍ਰੈਲ ਦੋ ਹਜ਼ਾਰ ਗਿਆਰ੍ਹਾਂ